ਇੱਕ ਵਾਰ ਮੈਂ ਫਲਿਪਕਾਡ 'ਤੇ ਸ਼ੋਪਿੰਗ ਕੀਤੀ ਦੇਖਿਆ ਕਿ ਉਸ 'ਤੇ ਲੈਪਟੋਪ ਬਹੁਤ ਸੋਹਣਾ ਸੀ ਜਦ ਮੈਂ ਉਹ ਲੈਪਟੋਪ ਔਡਰ ਕੀਤਾ ਉਹ ਫਿਰ ਮੇਰੇ ਚਾਰ ਪੰਜ ਦਿਨ ਬਾਅਦ ਘਰ ਆਇਆ ਜਦ ਮੈਂ ਉਸਨੂੰ ਖੋਲ੍ਹ ਕੇ ਦੇਖਿਆ ਤਾਂ ਉਹ ਬਿਲਕੁਲ ਹੀ ਉਸ ਉਹ ਵਾਲਾ ਨਹੀਂ ਸੀ ਜਿਹੜਾ ਮੈਂ ਦੇਖਿਆ ਸੀ ਸ਼ੋਪਿੰਗ ਵਿੱਚ ਉਸਦਾ ਪ੍ਰੋਸੈਸਰ ਨਹੀਂ ਸਹੀ ਸੀ ਅਤੇ ਜੋ ਉਹਨਾਂ ਨੇ ਦਿਖਾਇਆ ਸੀ ਉਹ ਰੈਮ ਵੀ ਨਹੀਂ ਸੀਗੀ ਜੋ ਕਿ ਮੈਂ ਉਸ ਵਿੱਚ ਆਪਣਾ ਆਪਣੇ ਵਾਸਤੇ ਓਫਿਸ਼ਅਲ ਵਰਕ ਵਾਸਤੇ ਦੇਖਿਆ ਸੀਗਾ ਸੋ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਅਸੀਂ ਚੀਜ਼ ਔਨਲਾਈਨ ਦੇਖਦੇ ਹਾਂ ਉਹ ਹੁੰਦੀ ਨਹੀਂ ਹੈ ਇਸ ਕਰਕੇ ਸਾਨੂੰ ਇਹ ਚੀਜ਼ਾਂ ਥੋੜ੍ਹਾ ਅਵੋਇਡ ਹੀ ਕਰਨੀਆਂ ਚਾਹੀਦੀਆਂ ਹਨ ਕਿ ਅਸੀਂ ਪੈਸੇ ਵੀ ਖਰਾਬ ਕਰਦੇ ਹਾਂ ਆਪਣਾ ਸਮਾਂ ਵੀ ਖਰਾਬ ਕਰਦੇ ਹਾਂ ਜਦਕਿ ਸਾਨੂੰ ਉੱਥੇ ਚੀਜ਼ਾਂ ਇਹ ਦੇਖਣ ਨੂੰ ਨਹੀਂ ਮਿਲਦੀਆਂ ਜੋ ਅਸੀਂ ਚੰਗੀ ਤਰ੍ਹਾਂ ਦੇਖ ਕੇ ਸ਼ੋਪਿੰਗ ਕਰ ਸਕੀਏ ਇਸ ਕਰਕੇ ਮੈਂ ਉਸ ਨੂੰ ਵਾਪਸ ਹੀ ਕਰਨਾ ਵਧੀਆ ਸਮਝਿਆ ਕਿ ਅੱਗੇ ਤੋਂ ਮੈਂ ਇਹ ਔਡਰ ਨਾ ਕਰਾਂ ਇਸ ਤਰ੍ਹਾਂ ਦੀਆਂ ਚੀਜ਼ਾਂ